ਸਤਿ ਸ਼੍ਰੀ ਅਕਾਲ ਜੀ ਕੋਈ ਗੱਲ ਕੋਈ ਕੋ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁਕਮ ਦੱਸੋ ਜੀ ਡੇਅਰੀ ਦੇ ਡੇਅਰੀ ਦੇ ਅਸੀਂ ਜਿੱਥੋਂ ਲੈਂਦੇ ਹਾਂ ਅਸੀਂ ਲੈਂਦੇ ਹਾਂ ਆਪਣੇ ਆਪਣੇ ਆਪਣੇ ਲੈਂਦੇ ਹਾਂ ਆਪਣੇ ਗਾਂਧੀ ਚੌਂਕ ਤੋਂ ਨਾ ਹਾਂਜੀ ਹਾਂਜੀ ਬਾਬਾ ਡੇਅਰੀ ਹੈ ਹਾਂਜੀ ਹਾਂਜੀ ਹਾਂਜੀ ਅਸੀਂ ਉੱਥੋਂ ਦੁੱਧ ਦਹੀਂ ਪਨੀਰ ਉੱਥੋਂ ਹੀ ਲਈਦਾ ਹਾਂਜੀ ਹਾਂਜੀ ਬਹੁਤ ਵਧੀਆ ਕੁਆਲਿਟੀ ਆ ਵਧੀਆ ਰੇਟ ਆ ਉਹਨਾਂ ਦਾ ਹਾਂਜੀ ਹਾਂਜੀ ਅਤੇ ਡੀਲਿੰਗ ਵੀ ਬਹੁਤ ਵਧੀਆ ਕਰਦੇ ਉਹ ਹਾਂਜੀ ਹਾਂ ਤੁਸੀਂ ਕੋਈ ਨਹੀਂ ਮੇਰੇ ਵੱਲੋਂ ਰੈਫਰੈਂਸ ਦੇ ਦਿਓ ਭਾਵੇਂ ਰੋਜੀ ਦੇ ਮੈਂ ਇੱਦਾਂ ਅ ਨੇਬਰ ਤੋਂ ਆਇਆ ਤਾਂ ਆਪਣੇ ਇੱਦਾਂ ਦਾ ਅਤੇ ਮਤਲਵ ਵਧੀਆ ਚੀਜ਼ ਦੇਣਗੇ ਤੁਹਾਨੂੰ ਕੋਈ ਗੱਲ ਨਹੀਂ ਠੀਕ ਧੰਨਵਾਦ ਜੀ ਧੰਨਵਾਦ